ਹੋਰ ਬਾਈ ਕੀ ਹਾਲ ਚਾਲ ਆ ਯਾਰ ਮੈਂ ਇੱਕ ਗੱਲ ਕਰਨੀ ਸੀ ਤੁਸੀਂ ਹੁਣ ਸ਼ਹਿਰ ਤੋਂ ਬਾਹਰ ਆ ਰਹੇ ਆ ਨਾ ਅਤੇ ਮੇਰਾ ਯਾਰ ਪਲੈਨ ਜਿਹਾ ਬਣਦਾ ਆਪਾਂ ਸਾਰੇ ਯਾਰ ਦੋਸਤ ਮਿਲ ਕੇ ਨਾ ਫਿਲਮ ਦੇਖ ਕੇ ਆਈਏ ਯਾਰ ਉੱਥੇ ਕਪੂਰਥਲੇ ਉੱਥੇ ਫਿਲਮ ਲੱਗੀ ਹੋਈ ਹੈ ਇਸਤਰੀ ਨਵੀਂ ਆਈ ਆ ਸਿਰਾ ਨਾਲੇ ਉਹਦੇ ਵਿੱਚ ਐਕਟਰ ਵੀ ਵਧੀਆ ਰਾਜਕੁਮਾਰ ਰਾਓ ਆ ਅਤੇ ਇੱਕ ਅ ਸ਼ਰਧਾ ਕਪੂਰ ਆ ਭੂਤਾਂ ਵਾਲੀ ਫਿਲਮ ਆ ਪਹਿਲਾਂ ਵੀ ਯਾਰ ਇਹਦਾ ਇੱਕ ਪਾਰਟ ਆਇਆ ਤਾ ਪਿਛਲੇ ਸਾਲ ਉਹ ਵੀ ਬਹੁਤ ਹਿੱਟ ਰਿਹਾ ਤਾ ਕਹਿੰਦੇ ਆਹ ਵਾਲਾ ਫ਼ਿਲਮ ਵੀ ਬਹੁਤ ਜ਼ਿਆਦਾ ਹਿੱਟ ਆ ਨਾਲੇ ਆਪਣੇ ਨਾਲ ਇੱਕ ਬਾਈ ਵੀ ਆ ਭੂਤਾਂ ਤੋਂ ਵੀ ਡਰਦਾ ਨਾਲੇ ਦਿਖਾਉਂਦੇ ਹਾਂ ਉਹਨੂੰ ਨਾਲੇ ਫਿਰ ਤੁਸੀਂ ਉੱਧਰ ਦੀ ਉੱਧਰ ਯਾਰ ਆਪਣਾ ਚੰਡੀਗੜ੍ਹ ਨੂੰ ਨਿਕਲ ਜਾਇਓ ਫਿਲਮ ਦੇਖ ਕੇ ਮੈਂ ਆਪਣਾ ਘਰ ਨੂੰ ਆਜੂਗਾ ਅਤੇ ਤੁਹਾਡਾ ਵੀ ਫਿਰ ਟਾਈਮ ਨਹੀਂ ਖ਼ਰਾਬ ਹੋਵੇਗੇ ਨਾਲੇ ਘੰਟੇ ਦੋ ਘੰਟੇ ਤੁਸੀਂ ਤਿੰਨ ਕੁ ਘੰਟੇ ਰੁਕਣਾ ਅਤੇ ਤਿੰਨ ਘੰਟੇ ਵਿੱਚ ਇੱਧਰ ਫਿਲਮ ਦੇਖ ਹੋਜੂਗੀ ਥੋੜ੍ਹਾ ਬਹੁਤਾ ਟਾਈਮ ਬਚਿਆ ਤਾਂ ਗੱਲਾਂ ਬਾਤਾਂ ਵੀ ਕਰ ਲਵਾਂਗੇ ਅਤੇ ਆਪਣਾ ਦੱਸਿਓ ਕਿੱਥੇ ਜਾਣਾ ਕਿਆ ਕਿਆ ਪ੍ਰੋਗਰਾਮ ਆ ਤੁਹਾਡੇ ਅੱਗੇ